ਸਮੇਂ ਨਾਲ਼ ਭਾਰਤ ਦਾ ਪੰਜਾਬ ਨਾਲ਼ ਰਿਸ਼ਤਾ ਕੁਝ ਇਸ ਤਰ੍ਹਾਂ ਹੈ ਜਿੱਦਾਂ ਕਿ ਪੰਜਾਬ ਵਿੱਚ ਪਹਿਲਾਂ ਜਦੋਂ ਭਾਰਤ ਦੀ ਵੰਡ ਹੋਈ ਤਾਂ ਪੰਜਾਬ ਵਿੱਚ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਠੀਕ ਆ ਇਸ ਤੋਂ ਬਾਅਦ ਇਸ ਇਸ ਤੋਂ ਬਾਅਦ ਇਸ ਵਿੱਚ ਹੋਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਜਾਂ ਹੋਰ ਤਰ੍ਹਾਂ ਦੀਆਂ ਵੰਡਾਂ ਕਾਰਨ ਜਿੱਦਾਂ ਕਿ ਜਿਵੇਂ ਕਿ ਪਹਿਲਾਂ ਹਰਿਆਣਾ ਵੀ ਕੱਢਿਆ ਅਤੇ ਵਿੱਚ ਹਿਮਾਚਲ ਵੀ ਕੱਢਿਆ ਗਿਆ ਠੀਕ ਆ ਇਨ੍ਹਾਂ ਤਬਦੀਲੀਆਂ ਕਾਰਨ ਭਾਰਤ ਹਮੇਸ਼ਾ ਪੰਜਾਬ ਨਾਲ ਵਿਤਕਰਾ ਹੀ ਕਰਦਾ ਰਹਿੰਦਾ ਹੈ